ਫਿਲਮਾਂ ਦੇਖਣ ਦਾ ਸ਼ੌਕ ਕਿਹਨੂੰ ਨਹੀਂ ਹੁੰਦਾ ਹਰ ਇੱਕ ਨੂੰ ਹੁੰਦਾ ਫਿਲਮਾਂ ਦੇਖਣ ਦਾ ਸ਼ੌਕ ਪਰ ਬਕਾਇਦਾ ਫਿਲਮਾਂ ਵਧੀਆਂ ਹੋਣ ਹਾਸੇ ਵਾਲੀਆਂ ਹੋਣ ਆਪਾਂ ਘਰ ਪਰਿਵਾਰ ਦੇ ਵਿੱਚ ਬੈਠ ਕੇ ਆਪਣੇ ਮਾਂ ਪਿਓ ਨਾਲ ਭੈਣ ਭਰਾਵਾਂ ਨਾਲ ਬੱਚਿਆਂ ਨਾਲ ਘਰ ਵਾਲੇ ਨਾਲ ਮਤਲਬ ਕਿ ਪਰਿਵਾਰਿਕ ਫਿਲਮਾਂ ਵਿੱਚ ਬੈਠ ਕੇ ਆਪਾਂ ਦੇਖ ਸਕੀਏ ਉਹੀ ਅਸਲੀ ਫਿਲਮਾਂ ਹੁੰਦੀਆਂ ਹਨ ਜਿਹਦੇ ਵਿੱਚ ਗੰਦ ਹੋਵੇ ਗਾਲੀ ਗਲੋਚ ਹੋਵੇ ਉਹ ਚੰਗਾ ਨਹੀਂ ਹੈਗਾ ਉਹ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਉਹ ਹੀ ਚੀਜ਼ ਬੱਚੇ ਸਾਡੇ ਸਿੱਖਦੇ ਨੇ ਆਉਣ ਵਾਲਾ ਅੱਜ ਸਾਡਾ ਉਹ ਸਭ ਕੁਝ ਸਿੱਖਦਾ ਵਾ ਸਾਡੇ ਘਰ ਪਰਿਵਾਰ ਮੇਰੇ ਪਰਿਵਾਰ ਦੇ ਸਾਰੇ ਜਿਹੜੇ ਜੀਅ ਸੀਗੇ ਮੈਂਬਰ ਸੀਗੇ ਉਹ ਘਰੋਂ ਬਾਹਰ ਗਏ ਹੋਏ ਸੀਗੇ ਅਤੇ ਮੈਂ ਸੋਚਿਆ ਕਿ ਕਿਉਂ ਨਾ ਫਿਲਮਾਂ ਫਿਲਮ ਦੇਖਣ ਦਾ ਮਨ ਬਣਾਇਆ ਜਾਵੇ ਤਾਂ ਮੈਂ ਬੁਕਿੰਗ ਕਰਾ ਲਈ ਲਾਗੇ ਇੱਕ ਸਿਨਿਮੇ ਦੇ ਵਿੱਚ ਅਰਦਾਸ ਕਰਾਂ ਇਹ ਫਿਲਮ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਸੀ ਬਹੁਤ ਜ਼ਿਆਦਾ ਵਧੀਆ ਅਤੇ ਪਰ ਬਹੁਤ ਸੁਣਿਆ ਵੀ ਸੀਗਾ ਮੈਂ ਸੋ ਮੈਂ ਟਿਕਟਾਂ ਬੁੱਕ ਕਰਾ ਲਈਆਂ ਫਿਰ ਮੈਂ ਆਪਦੇ ਘਰ ਪ ਘਰ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਤਾਂ ਉਹਨਾਂ ਨੂੰ ਪੁੱਛਿਆ ਵੀ ਤਾਂ ਤੁਸੀਂ ਕਿੱਥੇ ਆ ਗਏ ਤਾਂ ਉਹ ਕਹਿੰਦੇ ਕਿ ਸਾਨੂੰ ਥੋੜ੍ਹਾ ਜਿਹਾ ਹਾਲੇ ਟੈਮ ਲੱਗੂਗਾ ਅਤੇ ਫਿਰ ਮੈਂ ਉਹਨਾਂ ਨੂੰ ਆਪਣਾ ਜਿਹੜੀਆਂ ਟਿਕਟਾਂ ਸੀਗੀਆਂ ਉਹਨਾਂ ਦਾ ਨੰਬਰ ਦੱਸ ਦਿੱਤਾ ਮੈਂ ਕਿਹਾ ਵੀ ਡੀ ਦਸ ਤੋਂ ਲੈ ਕੇ ਡੀ ਪੰਦਰਾਂ ਤੱਕ ਆਪਣੀ ਬੁਕਿੰਗ ਹੋ ਚੁੱਕੀ ਆ ਅਤੇ ਤੁਸੀਂ ਟੈਮ ਨਾਲ ਆ ਜਾਇਓ ਤਾਂ ਕਿ ਉਸ ਫਿਲਮ ਦਾ ਇੱਕ ਵੀ ਸੀਨ ਨਾ ਮਿਸ ਹੋ ਜਾਏ ਇਹ ਜਿਹੜੀ ਫਿਲਮ ਆ ਇਹਦੇ ਵਿੱਚ ਗਿੱਪੀ ਗਰੇਵਾਲ ਰਾਣਾ ਰਣਬੀਰ ਗੁਰਪ੍ਰੀਤ ਘੁੱਗੀ ਇਹ ਕਰੈਕਟਰ ਨੇ ਇਹ ਮਹਾਨ ਹਸਤੀਆਂ ਨੇ ਅਤੇ ਹਾਸਾ ਵੀ ਬਹੁਤ ਆ ਬਾਤ ਇਸ ਦੇ ਮਨੋਰੰਜਨ ਵੀ ਬਹੁਤ ਜ਼ਿਆਦਾ ਵਾ ਖੁਸ਼ੀ ਬਾਹਲੀ ਆ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਵੱਡੇ ਨੇ ਐਲਡਰ ਨੇ ਸਾਡੇ ਵੱਡੇ ਬਜ਼ੁਰਗ ਨੇ ਉਹਨਾਂ ਦੀ ਹਾਲਤ ਕੀ ਹੁੰਦੀ ਹੈ ਉਹਨਾਂ ਨੂੰ ਕਿੱਦਾਂ ਦਾ ਉਹਨਾਂ ਨਾਲ ਪੇਸ਼ ਕੀਤਾ ਜਾਂਦਾ ਉਹਨਾਂ ਨੂੰ ਕਿੱਦਾਂ ਲੋਕ ਜਿਹੜੇ ਘਰ ਪਰਿਵਾਰ ਵਾਲੇ ਹੁੰਦੇ ਆ ਕਿੱਦਾਂ ਉਹਨਾਂ ਨੂੰ ਗੁੱਸਾ ਕਰਦੇ ਆ ਡਾਂਟ ਦੇ ਆ ਝਿੜਕਦੇ ਆ ਬੱਚਿਆਂ ਨੂੰ ਨਾਲ ਪਿਆਰ ਨਹੀਂ ਕਰਨ ਦਿੰਦੇ ਬੱਚਿਆਂ ਨਾਲ ਗੱਲਾਂ ਬਾਤਾਂ ਨਹੀਂ ਕਰਨ ਦਿੰਦੇ ਬੱਚਿਆਂ ਨਾਲ ਖੇਡਣ ਨਹੀਂ ਦਿੰਦੇ ਉਹਨਾਂ ਨੂੰ ਕੋਈ ਰੋਟੀ ਪਾਣੀ ਨਹੀਂ ਕੋਈ ਟੈਮ ਨਾਲ ਨਹੀਂ ਮਿਲਦਾ ਸਗੋਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਰਾਤ ਦੀ ਰੋਟੀ ਪਾਣੀ ਆਪ ਕਰਨਾ ਪੈਂਦਾ ਵਾ ਇਸ ਫਿਲਮ ਦੇ ਵਿੱਚ ਦੱਸਿਆ ਕਿ ਉਹ ਸਾਰੀ ਜ਼ਿੰਦਗੀ ਆਪਦੇ ਬੱਚਿਆਂ ਲਈ ਕਮਾਉਂਦੇ ਰਹਿੰਦੇ ਆ ਅਤੇ ਆਖਰ ਦੇ ਵਿੱਚ ਬੱਚੇ ਕੀ ਆ ਬੱਚੇ ਉਹਨਾਂ ਨੂੰ ਲਾਹਣਤਾਂ ਪਾਉਂਦੇ ਆ ਉਹਨਾਂ ਨੂੰ ਗੁੱਸਾ ਕਰਦੇ ਆ ਡਾਂਟਦੇ ਆ ਆਪਦੇ ਬੱਚਿਆ ਨੂੰ ਕਹਿੰਦੇ ਆ ਕਿ ਤੁਸੀਂ ਇਹਨਾਂ ਨਾਲ ਬੋਲਣਾ ਨਹੀਂ ਗੱਲ ਨਹੀਂ ਕਰਨੀ ਹੈਗੀ ਇਹ ਤੁਹਾਨੂੰ ਗਲਤ ਚੀਜ਼ਾਂ ਸਿਖਾਉਂਦੇ ਨੇ ਜਿਹਨਾਂ ਨੇ ਤੁਹਾਨੂੰ ਪਾਲ ਪੋਸ ਕੇ ਅੱਜ ਇੱਥੋਂ ਤੱਕ ਕਰਤਾ ਇੱਥੋਂ ਤੱਕ ਲਿਆ ਦਿੱਤਾ ਇੱਥੋਂ ਤੱਕ ਵੱਡਾ ਕਰਤਾ ਅੱਜ ਉਹ ਤੁਹਾਡੇ ਬੱਚੇ ਨੂੰ ਗਲਤ ਸਿਖਾਉਣਗੇ ਇਹ ਸਿੱਖਿਆ ਤੁਹਾਨੂੰ ਕਿਹਨੇ ਦੇ ਦਿੱਤੀ ਪਹਿਲੀ ਗੱਲ ਤਾਂ ਇਹ ਹੈ ਇਹ ਫਿਲਮ ਇੰਨੀ ਵਧੀਆ ਸੀਗੀ ਕਿ ਇਹਦੇ ਵਿੱਚ ਤਿੰਨ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਆਪਦੀ ਜਿੰਦ ਉਹ ਉਹਨਾਂ ਨੂੰ ਘਰੋਂ ਕੀ ਹੈ ਕਿ ਗੁੱਸਾ ਕਰਦੇ ਆ ਲੜਦੇ ਆ ਝਗੜਦੇ ਆ ਮਿਹਣੇ ਮਾਰਦੇ ਆ ਤਾਹਨੇ ਮਾਰਦੇ ਆ ਉਹ ਕੀ ਆ ਕਿ ਆਪਦੇ ਘਰੋਂ ਨਿਕਲ ਜਾਂਦੇ ਨੇ ਅਤੇ ਜਿਹੜਾ ਗੁਰਪ੍ਰੀਤ ਘੁੱਗੀ ਅਤੇ ਗਿੱਪੀ ਗਰੇਵਾਲ ਨੇ ਰਾਣਾ ਰਣਵੀਰ ਨੇ ਇਹਨਾਂ ਨੇ ਇੱਕ ਆਪਾਂ ਕੈਪ ਕਹਿ ਲਓ ਟੈਕਸੀ ਕਹਿ ਲਓ ਉਹ ਟੈਕਸੀ ਦੇ ਵਿੱਚ ਇਹਨਾਂ ਨੂੰ ਦੁਨੀਆਂ ਦੇ ਵਿੱਚ ਘੁੰਮਾਉਣ ਲੈ ਕੇ ਜਾਂਦੇ ਆ ਘੁੰਮਾਉਂਦੇ ਆ ਉਹ ਹੱਸਦੇ ਆ ਖੇਡਦੇ ਆ ਆਪਣੇ ਦੁੱਖ ਦਰਦ ਤਕਲੀਫਾਂ ਸਭ ਕੁਛ ਭੁੱਲ ਜਾਂਦੇ ਆ ਉਹ ਆਪਦੀ ਜ਼ਿੰਦਗੀ ਜਿਊਣ ਲੱਗ ਪੈਂਦੇ ਆ ਸੋ ਇਹ ਜਿਹੜੀ ਫਿਲਮ ਹੈ ਇਸ ਕਰਕੇ ਮੈਂ ਇਹਦੀ ਬੁਕਿੰਗ ਕੀਤੀ ਸੀਗੀ ਇਹਦਾ ਜ਼ਿਕਰ ਮੈਂ ਆਪਦੇ ਘਰ ਪਰਿਵਾਰ ਵਾਲਿਆਂ ਨਾਲ ਵੀ ਕੀਤਾ ਸੀ ਕਿ ਆਪਾਂ ਇਹ ਫਿਲਮ ਦੇਖਣ ਚਲਾਂਗੇ